ਸਤਿ ਸ਼੍ਰੀ ਅਕਾਲ ਜੀ ਮੈਂ ਭਾਵੀਕਾ ਜ਼ਿਲ੍ਹਾ ਨਿਵਾਸੀ ਪਠਾਨਕੋਟ ਤੋਂ ਬੋਲ ਰਹੀ ਹਾਂ ਮੈਂ ਅੱਜ ਤੁਹਾਨੂੰ ਆਪਣੇ ਪਰਿਵਾਰਕ ਪਕਵਾਨ ਬਾਰੇ ਦੱਸਣ ਜਾ ਰਹੀ ਹਾਂ ਜੋ ਕਿ ਅਸੀਂ ਅਕਸਰ ਬਣਾਉਂਦੇ ਰਹਿੰਦੇ ਹਾਂ ਜਿਸ ਨੂੰ ਬਣਾਉਣ ਦੀ ਵਿਧੀ ਵੀ ਬਹੁਤ ਹੀ ਜ਼ਿਆਦਾ ਅਸਾਨ ਹੈ ਪਰ ਸਾਡੇ ਮੁਹੱਲੇ ਦੇ ਲੋਕਾਂ ਨੂੰ ਤਾਂ ਇਸ ਬਾਰੇ ਇੰਨਾ ਜ਼ਿਆਦਾ ਪਤਾ ਨਹੀਂ ਹੈ ਇਸ ਦਾ ਨਾਂ ਬਬਰੂ ਹੈ ਇਹ ਆਟੇ ਨੂੰ ਰਾਤ ਨੂੰ ਗੁੰਨ ਕੇ ਸਵੇਰੇ ਉਸ ਵਿੱਚ ਚੀਨੀ ਪਾ ਕੇ ਫਿਰ ਉਸਨੂੰ ਗਰਮ ਗਰਮ ਤੇਲ ਵਿੱਚ ਤਲ ਕੇ ਬਣਾਉਂਦੇ ਹਨ ਜੋ ਮਿੱਠੇ ਅਤੇ ਸਵਾਦਿਸ਼ਟ ਹੁੰਦੇ ਹਨ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਸਲਾਹ ਦੇਣਾ ਚਾਹੂੰਗੀ ਕਿ ਤੁਸੀਂ ਸਾਰੇ ਵੀ ਇਹ ਬਣਾ ਕੇ ਇੱਕ ਵਾਰ ਜ਼ਰੂਰ ਟਰਾਏ ਕਰੋ ਧੰਨਵਾਦ